ਅਸੀਂ ਹਰੀਕੇ ਵਰਡ ਸੈਂਚਰੀ ਵਿੱਚ ਦੁਰਲੱਭ ਪੰਛੀ ਸੁਰਖ਼ਾਬ ਦੇਖਿਆ ਜਿਸ ਦਾ ਦਿੱਖ ਦੂਸਰੇ ਪੰਛੀਆਂ ਤੋਂ ਬਹੁਤ ਵੱਖਰੀ ਸੀ ਉਹ ਦੂਸਰੇ ਪੰਛੀਆਂ ਤੋਂ ਜ਼ਿਆਦਾ ਖਿੱਚ ਦਾ ਕੇਂਦਰ ਬਣ ਰਿਹਾ ਸੀ ਇਸ ਤਰ੍ਹਾਂ ਪੰਛੀ ਸਰਵਾਈਵ ਕਰਦੇ ਨੇ ਅਤੇ ਆਪਣਾ ਜੀਵਨ ਬਤੀਤ ਕਰਦੇ ਨੇ ਅਸੀਂ ਉਸ ਦੁਰਲੱਭ ਪੰਛੀ ਵੱਲ ਵਾਰ ਵਾਰ ਦੇਖ ਰਹੇ ਸੀ ਉਹ ਦੂਸਰੇ ਪੰਛੀਆਂ ਤੋਂ ਜ਼ਿਆਦਾ ਵੱਖਰਾ ਅਤੇ ਸੁੰਦਰ ਸੀ ਜੋ ਵੀ ਉਸ ਵੱਲ ਦੇਖਦਾ ਸੀ ਉਹ ਖਿੱਚ ਦਾ ਕਾਰਨ ਬਣਦਾ ਸੀ

ਜੋ ਦਿੱਖ ਸੀ ਬਹੁਤ ਅਜੀਬ ਤਰ੍ਹਾਂ ਦੀ ਸੀ